ਸਿੱਖਿਅਤ ਜਿਹੜਾ ਵਿਅਕਤੀ ਹੁੰਦਾ ਹੈ ਉਹਦੇ ਸਿਧਾਂਤਾਂ 'ਚ ਵੈਸੇ ਵੀ ਬਹੁਤ ਹੀ ਫ਼ਰਕ ਹੁੰਦਾ ਜਿਹੜਾ ਇੱਕ ਅਨਪੜ੍ਹ ਬੰਦਾ ਹੁੰਦਾ ਉਹਦੇ ਨਾਲੋ ਇਹ ਆਪਾਂ ਇੱਦਾਂ ਕਹਿ ਸਕਦੇ ਹੈ ਕਿ ਜਿਹੜਾ ਸਿੱਖਿਅਤ ਵਿਅਕਤੀ ਹੁੰਦਾ ਹੈ ਉਹ ਬਹੁਤ ਸਾਰੇ ਜਿਹੜੇ ਆਪਣੇ ਸਿਧਾਂਤ ਨੇ ਉਹਨਾਂ ਨੂੰ ਬੜੇ ਚੰਗੇ ਤਰੀਕੇ ਨਾਲ ਉਹਨਾਂ ਨੂੰ ਮੈਨੇਜ ਵੀ ਕਰਦਾ ਅਤੇ ਫੋਲੋ ਵੀ ਕਰਦਾ ਹੈ ਜਿਵੇਂ ਕਿ ਕਹਿ ਸਕਦੇ ਹਨ ਇੱਕ ਸਿੱਖਿਅਤ ਵਿਅਕਤੀ ਜਿਹੜਾ ਕੂੜਾ ਕਰਕਟ ਜਿਹੜਾ ਹੈ ਉਹ ਰਸਤੇ 'ਚ ਨਹੀਂ ਕਦੇ ਸੁੱਟੇਗਾ ਉਹ ਉਹਨੂੰ ਚੰਗੇ ਤਰੀਕੇ ਨਾਲ ਉਹਨੂੰ ਇੱਕ ਚੰਗੀ ਜਗ੍ਹਾ 'ਤੇ ਉਹਨੂੰ ਲਗਾਉਂਦਾ ਹੈ ਅਤੇ ਜੇ ਆਪਾਂ ਇੱਕ ਅਨਪੜ੍ਹ ਵਿਅਕਤੀ ਦੀ ਗੱਲ ਕਰੀਏ ਤਾਂ ਉਹ ਕੂੜਾ ਕਿਤੇ ਵੀ ਸੁੱਟ ਦਿੰਦੇ ਹਨ ਉਹ ਕਿਤੇ ਵੀ ਥੁੱਕ ਦਿੰਦੇ ਹਨ ਅਤੇ ਬਹੁਤ ਜਿਹੜੀ ਗਲਤ ਜਿਹੜੇ ਕੰਮ ਹੈ ਉਹ ਕਰਦੇ ਹਨ ਸਿੱਖਿਅਤ ਵਿਅਕਤੀ ਜਿਹੜਾ ਹੈ ਇੱਕ ਦੂਜੇ ਨੂੰ ਮਦ ਲੋਕਾਂ ਦੀ ਮਦਦ ਕਰਨ 'ਤੇ ਜ਼ਿਆਦਾ ਵਿਸ਼ਵਾਸ ਰੱਖਦਾ ਹੈ ਜਿਹੜੇ ਅਨਪੜ ਵਿਅਕਤੀ ਹੁੰਦੇ ਹੈ ਉਹ ਜ਼ਿਆਦਾਤਰ ਲੋਕਾਂ ਦੀ ਮਦਦ ਨਹੀਂ ਕਰਨਾ ਚਾਹੁੰਦੇ ਉਹ ਜ਼ਿਆਦਾਤਰ ਆਪਣੇ ਹੀ ਬਾਰੇ ਸੋਚਦੇ ਹਨ ਜਿਸ ਦੇ ਕਰਕੇ ਨਾ ਉਹ ਖੁਦ ਅੱਗੇ ਵੱਧ ਪਾਉਂਦੇ ਹਨ ਨਾ ਹੀ ਉਹ ਦੂਸਰੇ ਨੂੰ ਅੱਗੇ ਵਧਣ ਦਿੰਦੇ ਹਨ ਇਸ ਤੋਂ ਇਲਾਵਾ ਜਿਹੜਾ ਇੱਕ ਸਿੱਖਿਅਤ ਵਿਅਕਤੀ ਹੈ ਉਹਨੂੰ ਬਹੁਤ ਸਾਰੇ ਦੂਸਰੀ ਚੰਗੀਆਂ ਚੀਜ਼ਾਂ ਦੀ ਅੱਛੀ ਨੋਲੇਜ ਹੁੰਦੀ ਹੈ ਜਿਵੇਂ ਕਿ ਉਹ ਇੱਕ ਵਧੀਆ ਇਨਵੈਸਟਰ ਹੁੰਦਾ ਹੈ ਉਹ ਚੰਗੀ ਜਗ੍ਹਾ 'ਤੇ ਆਪਣਾ ਜਿਹੜਾ ਟਾਈਮ ਅਤੇ ਪੈਸਾ ਇਨਵੈਸਟ ਕਰਕੇ ਆਪਣੇ ਆਪ ਨੂੰ ਵੀ ਅੱਗੇ ਵਧਾਉਂਦਾ ਹੈ ਅਤੇ ਆਪਣੇ ਦੇਸ਼ ਨੂੰ ਵੀ ਅੱਗੇ ਵਧਾਉਂਦਾ ਹੈ ਜੇ ਆਪਾਂ ਇਕ ਅਨਪੜ੍ਹ ਵਿਅਕਤੀ ਜਿਹੜਾ ਅਨਸਿੱਖਿਅਤ ਵਿਅਕਤੀ ਹੁੰਦਾ ਹੈ ਉਹਨੂੰ ਉਹਦੇ ਨਾਲ਼ ਜੇ ਆਪਾਂ ਇਹਨੂੰ ਕੰਪੇਅਰ ਕਰੀਏ ਤਾਂ ਉਹ ਕਦੀ ਵੀ ਅੱਗੇ ਵਧਣ 'ਚ ਮਦਦ ਨਹੀਂ ਕਰਦੇ